ਅਸੀਂ ਕਾਫੀ ਪੌਦੇ ਉਗਾਏ ਹੋਏ ਹਨ ਉੱਪਰ ਆਪਣੇ ਗਮਲਿਆਂ ਵਿੱਚ ਜਿਵੇਂ ਕਿ ਤੁਲਸੀ ਹੋ ਗਈ ਧਨੀਆ ਹੋ ਗਿਆ ਪੁਦੀਨਾ ਹੋ ਗਿਆ ਧਨੀਆ ਵੀ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੁੰਦੇ ਆ ਹਰ ਸਬਜ਼ੀ ਵਿੱਚ ਅਸੀਂ ਧਨੀਆ ਵੀ ਪਾਉਂਦੇ ਹਾਂ ਅਤੇ ਪੁਦੀਨੇ ਦੀ ਚਟਨੀ ਜਿੱਦਾਂ ਹਾਜ਼ਮਾ ਵਧੀਆ ਹੋ ਜਾਂਦਾ ਇਸ ਕਰਕੇ ਧਨੀਏ ਪੁਦੀਨੇ ਅਤੇ ਧਨੀਏ ਦੀ ਚਟਨੀ ਵੀ ਬਹੁਤ ਹੀ ਅੱਛੀ ਬਣਦੀ ਹੈ ਦੂਜਾ ਆ ਗਿਆ ਤੁਲਸੀ ਜਿੱਦਾਂ ਅਸੀਂ ਤੁਲਸੀ ਦਾ ਬੂਟਾ ਘਰ ਲਗਾਇਆ ਹੋਇਆ ਤੁਲਸੀ ਵੀ ਚਾਹ ਦੇ ਵਿੱਚ ਪਾ ਕੇ ਕਾਫੀ ਫਾਇਦਾ ਕਰਦੀ ਹੈ ਸਾਨੂੰ ਇਸ ਕਰਕੇ ਸਾਨੂੰ ਜਿਹੜੀ ਇਹ ਜੜੀਆਂ ਬੂਟੀਆਂ ਹੁੰਦੀਆਂ ਇਹ ਸਾਡੇ ਸਿਹਤ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਇਸ ਕਰਕੇ ਇਹਨਾਂ ਬੂਟ ਜੜੀਆਂ ਬੂਟੀਆਂ ਦੀਆਂ ਬਹੁਤ ਜ਼ਿਆਦਾ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਤੰਦਰੁਸਤ ਰਹੀਏ ਜਿਵੇਂ ਕਿ ਧਨੀਆ ਹੋ ਗਿਆ ਪੁਦੀਨਾ ਹੋ ਗਿਆ ਪੁਦੀਨਾ ਜਿਹੜਾ ਹੈ ਉਹ ਬਹੁਤ ਹੀ ਵਧੀਆ ਚੀਜ਼ ਹੈ ਪੁਦੀਨੇ ਦੀ ਚਟਨੀ ਵੀ ਬਣ ਸਕਦੀ ਹੈ ਪੁਦੀਨੇ ਤੋਂ ਹੋਰ ਕਈ ਦਵਾਈਆਂ ਵਿੱਚ ਵੀ ਗੁਣਕਾਰੀ ਹੁੰਦਾ ਹੈ ਤੁਲਸੀ ਦੇ ਨਾਲ ਵੀ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਜਿਹਦੇ ਨਾਲ ਕਿ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਇਸ ਕਰਕੇ ਸਾਨੂੰ ਜੜੀ ਬੂਟੀਆਂ ਉਗਾਉਣ ਲਈ ਅਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਜਿੱਦਾਂ ਵਧੀਆ ਖਾਦ ਪਾਉਣੀ ਬੂਟਿਆਂ ਦੇ ਵਿੱਚ ਅਤੇ ਹੋਰ ਵਧੀਆ ਬੂਟਾ ਲਗਾਉਣ ਵਾਸਤੇ ਅ ਸਾਨੂੰ ਰੋਜ਼ ਪਾਣੀ ਦੇਣ ਦੀ ਲੋੜ ਹੈ ਉਹਨੂੰ ਸਹੀ ਧੁੱਪ ਵੀ ਮਿਲਣੀ ਚਾਹੀਦੀ ਹੈ ਤਾਂ ਕਿ ਅਸੀਂ ਵਧੀਆ ਤੋਂ ਵਧੀਆ ਜੜੀ ਬੂਟੀਆਂ ਪ੍ਰਾਪਤ ਕਰ ਸਕੀਏ ਜੜੀ ਬੂਟੀਆਂ ਦਾ ਸਾਡੇ ਜੀਵਨ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਅਤੇ ਜੜੀ ਬੂਟੀਆਂ ਦੇ ਨਾਲ ਹੀ ਸਾਡਾ ਅਸੀਂ ਵਧੀਆ ਤੋਂ ਵਧੀਆ ਕਰ ਸਕਦੇ ਹਾਂ ਜੜੀ ਬੂਟੀਆਂ ਦੇ ਨਾਲ ਹੀ ਅਸੀਂ ਆਪਣੇ ਖਾਣੇ ਦੇ ਵਿੱਚ ਵਧੀਆ ਟੇਸਟ ਲਿਆ ਸਕਦੇ ਹਾਂ ਜਿੱਦਾਂ ਧਨੀਏ ਦੀ ਵਰਤੋਂ ਹੋ ਗਈ ਪੁਦੀਨੇ ਦੀ ਵਰਤੋਂ ਹੋ ਗਈ ਪੁਦੀਨੇ ਦੇ ਨਾਲ ਵੀ ਸਾਡਾ ਬਹੁਤ ਜ਼ਿਆਦਾ ਮਤਲਬ ਕਿ ਹੋ ਸਕਦਾ ਹੈ ਤੁ ਤੁਲਸੀ ਤੁਲਸੀ ਤਾਂ ਅਸੀਂ ਐਕਸਪਲੇਨ ਕਰੀਏ ਤੁਲਸੀ ਤਾਂ ਬਹੁਤ ਜ਼ਿਆਦਾ ਦਵਾਈਆਂ ਵਿੱਚ ਵੀ ਉਪਯੋਗ ਹੁੰਦੀ ਆ ਭਗਵਾਨ ਨੂੰ ਭੋਗ ਲਗਾਉਣ ਦੇ ਵਿੱਚ ਵੀ ਤੁਲਸੀ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਧਨੀਆ ਅਤੇ ਜਿਹੜੀ ਹੈ ਪੁਦੀਨਾ ਇਹਦੀ ਵੀ ਬਹੁਤ ਜ਼ਿਆਦਾ ਦਵਾਈਆਂ ਵੀ ਬਣਦੀਆਂ ਅਤੇ ਚਟਨੀ ਦੀ ਵੀ ਬਹੁਤ ਵਧੀਆ ਅਸੀਂ ਪ੍ਰਯੋਗ ਕਰ ਸਕਦੇ